ਅਭਿਆਸ ਤੋਂ ਇਲਾਵਾ ਬਿਹਤਰ ਅਵਾਜ਼ ਲਈ ਅਸੀਂ ਗਰਮ ਪਾਣੀ ਨਾਲ ਇਲਾਚੀਆਂ ਦਾ ਇਲਾਚੀਆਂ ਦਾ ਕਰਦੇ ਹਾਂ ਅਤੇ ਅਤੇ ਤਲੀਆਂ ਜੋ ਚੀਜ਼ਾਂ ਨੂੰ ਅਵੋਇਡ ਕਰਦੇ ਹਾਂ ਅਤੇ ਠੰਡਾ ਅਤੇ ਖੱਟਾ ਮਸਾਲੇਦਾਰ ਖਾਣਾ ਘੱਟ ਖਾਣਾ ਜਾਂ ਘੱਟ ਹੀ ਖਾਣਾ ਚਾਹੀਦਾ ਹੈ ਗਲੇ ਦੀ ਅਵਾਜ਼ ਵਾਸਤੇ